ਸਤਿ ਸ਼੍ਰੀ ਅਕਾਲ ਜੀ ਸ਼ਾਮ ਢਾਬੇ ਤੋਂ ਬੋਲਦੇ ਹੋ ਮੈਂ ਤੁਹਾਨੂੰ ਪਹਿਲਾਂ ਆਰਡਰ ਕੀਤਾ ਸੀ ਹੁਣ ਉਸ ਵਿੱਚ ਮੈਂ ਕੁਝ ਤਬਦੀਲੀ ਕਰਵਾਉਣਾ ਚਾਹੁੰਦੀ ਹਾਂ ਮੈਂ ਆਰਡਰ ਵਿੱਚ ਪਹਿਲਾਂ ਦੋ ਰੋਟੀਆਂ ਕਹੀਆਂ ਸਨ ਅਤੇ ਹੁਣ ਦੋ ਰੋਟੀਆਂ ਦੀ ਬਜਾਏ ਮੈਨੂੰ ਆਰਡਰ ਵਿੱਚ ਇੱਕ ਰੋ ਚਪਾਤੀ ਚਾਹੀਦੀ ਹੈ ਕਿਰਪਾ ਕਰਕੇ ਆਰਡਰ ਵਿੱਚ ਤਬਦੀਲੀ ਕਰਕੇ ਮੈਨੂੰ ਜਲਦੀ ਤੋਂ ਜਲਦੀ ਖਾਣਾ ਭੇਜਣ ਦੀ ਕਿਰਪਾਲਤਾ ਕਰਨੀ ਜੀ ਧੰਨਵਾਦ